ਹੈਲੋ ਹਾਂਜੀ ਗੁਡ ਈਵਨਿੰਗ ਮੈਮ ਮੈਮ ਲੋਨ ਕੰਪਨੀ ਤੋਂ ਬੋਲ ਰਹੇ ਹੋ ਹਾਂਜੀ ਐਕਚੁਲੀ ਮੈਮ ਮੈਂ ਕਾਰ ਲੋਨ ਸੈਂਕਸ਼ਨ ਕਰਵਾਉਣਾ ਸੀ

ਹਾਂਜੀ ਟੈਨ ਲੈਖ ਨੀਅਰ ਅਬਾਊਟ ਟੈਨ ਲੈਖ ਅਤੇ ਮੈਨੂੰ ਇੰਟਰਸਟ ਰੇਟ ਵਗੈਰਾ ਸਭ ਉਹ ਕਲੀਅਰ ਕਰ ਸਕਦੇ ਹੋ

ਮੈਕਸੀਮਮ ਫਾਈਵ ਈਅਰਸ ਵਿੱਚ ਕਲੀਅਰ ਹੋ ਜਾਏਗਾ ਓਕੇ ਮੈਮ ਹਾਂਜੀ ਓਕੇ ਮੈਮ ਹੋਰ ਇਹਦੇ ਲਈ ਕੁਛ ਡਾਊਨ ਪੇਮੈਂਟ ਵਗੈਰਾ ਵੀ ਹੁੰਦੀ ਹੈ ਸਿਕਿਓਰਿਟੀ ਬੇਸ ਕੁਛ ਤੁਸੀਂ ਓਕੇ ਮੈਮ ਡਿਸਕਾ ਹਮ ਹਾਂਜੀ ਯੈਸ ਹਾਂਜੀ ਸਵਿਫਟ ਡਿਜ਼ਾਈਰ ਦਾ ਲੇਟਸਟ ਮਾਡਲ ਹੈ ਨਾ ਹਾਂਜੀ ਮੈਮ ਫਾਰਮੈਲਿਟੀਜ਼ ਹਾਂਜੀ ਥੋੜ੍ਹਾ ਮੈਨੂੰ ਦੱਸ ਦਿਓ ਕਿਹੜੇ ਕਿਹੜੇ ਡਾਕੂਮੈਂਟਸ ਵਗੈਰਾ ਚਾਹੀਦੇ ਹੋਣਗੇ

ਓਕੇ ਮੈਮ ਓਕੇ ਮੈਮ ਹਾਂਜੀ ਐਚ ਡੀ ਐਫ ਸੀ 'ਚ ਹੈ ਮੈਮ ਅਕਾਊਂਟ ਓਕੇ ਮੈਮ ਥੈਂਕ ਯੂ ਮੈਮ ਥੈਂਕ ਯੂ ਮੈਂ ਫਿਰ ਆਉਂਦੀ ਹਾਂ ਤੁਹਾਡੇ ਕੋਲ ਓਕੇ ਮੈਮ ਥੈਂਕ ਯੂ